ਕੀ ਤੁਸੀਂ ਭੋਲਾ ਸਵੀਟਸ ਐਂਡ ਰੈਸਟੋਰੈਂਟ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਅੱਜ ਫ਼ੋਨ ਤਾਂ ਕੀਤਾ ਹੈ ਅਸੀਂ ਤੁਹਾਡੇ ਰੈਸਟੋਰੈਂਟ ਤੋਂ ਅੱਜ ਖਾਣਾ ਮੰਗਵਾਇਆ ਸੀ ਸਾਨੂੰ ਤੁਹਾਡੇ ਰੈਸਟੋਰੈਂਟ 'ਤੇ ਬਹੁਤ ਵਿਸ਼ਵਾਸ ਸੀ ਅਸੀਂ ਪਹਿਲਾਂ ਵੀ ਤੁਹਾਡੇ ਰੈਸਟੋਰੈਂਟ ਤੋਂ ਕਈ ਵਾਰ ਖਾਣਾ ਮੰਗਵਾਇਆ ਪਰ ਅੱਜ ਜੋ ਹੋਇਆ ਉਸਦੀ ਤੁਹਾਡੇ ਤੋਂ ਉਮੀਦ ਨਹੀਂ ਸੀ ਅਸੀਂ ਖਾਣੇ ਵਿੱਚ ਦਾਲ ਮੱਖਣੀ ਨਾਨ ਸ਼ਾਹੀ ਪਨੀਰ ਅਤੇ ਹੋਰ ਮਠਿਆਈ ਵਗੈਰਾ ਔਡਰ ਕੀਤੀ ਸੀ ਡਿਲੀਵਰੀ ਵਾਲਾ ਮੁੰਡਾ ਜਦੋਂ ਖਾਣੇ ਦੀ ਡਿਲੀਵਰੀ ਦੇ ਕੇ ਗਿਆ ਇੱਕ ਤਾਂ ਉਹ ਬਹੁਤ ਦੇਰ ਨਾਲ ਦੇ ਕੇ ਗਿਆ ਫਿਰ ਜਦੋਂ ਅਸੀਂ ਪੈਕਿੰਗ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਕੁਝ ਹੋਰ ਹੀ ਆਈਟਮਾਂ ਸਨ ਖਾਣੇ ਦੀ ਪੈਕਿੰਗ ਵੀ ਚੰਗੀ ਨਹੀਂ ਸੀ ਨਾ ਉਸ ਵਿੱਚੋਂ ਮਠਿਆਈ ਨਿਕਲੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਸਾਡਾ ਦੇਖ ਕੇ ਬਹੁਤ ਮੂਡ ਖਰਾਬ ਹੋਇਆ ਤੁਸੀਂ ਆਪਣਾ ਡਿਲੀਵਰੀ ਵਾਲਾ ਮੁੰਡਾ ਵਾਪਸ ਭੇਜ ਕੇ ਇਹ ਖਾਣਾ ਵਾਪਸ ਮੰਗਵਾ ਲਵੋ ਅਤੇ ਸਾਡੇ ਦਿੱਤੇ ਔਡਰ ਦੀਆਂ ਚੀਜ਼ਾਂ ਸਾਨੂੰ ਭੇਜੋ ਜੇ ਤੁਹਾਡੇ ਕੋਲ ਸਾਢੇ ਕੁ ਔਡਰ ਕੀਤੀਆਂ ਆਈਟਮਾਂ ਤਿਆਰ ਨਹੀਂ ਹਨ ਤਾਂ ਸਾਡੇ ਔਡਰ ਦੇ ਪੈਸੇ ਵਾਪਸ ਕੀਤੇ ਜਾਣ